ਤੁਸੀਂ ਗੈਂਸ ਸਿਲੰਡਰ ਦੀ ਬੁਕਿੰਗ ਗੈਸ ਸਲੰਡਰ ਵਾਲੀ ਏਜੰਸੀ ਤੋਂ ਬੋਲ ਰਹੇ ਹੋ ਮੈਂ ਆਪਣੀ ਗੈਂਸ ਸਲੰਡਰ ਦੀ ਬੁਕਿੰਗ ਕੈਂਸਲ ਕਰਵਾਉਣੀ ਹੈ ਮੇਰੇ ਗੈਸ ਸਲੰਡਰ ਦਾ ਬੁਕਿੰਗ ਦਾ ਨੰਬਰ ਪੰਜ ਚਾਰ ਸੱਤ ਇੱਕ ਨੌ ਹੈ ਮੈਂ ਇਸ ਬੁਕਿੰਗ ਨੂੰ ਰੱਦ ਇਸ ਲਈ ਕਰਵਾਉਣਾ ਹੈ ਕਿਉਂਕਿ ਸਾਡੇ ਘਰ ਗੈਸ ਦੀ ਇੰਨੀ ਲਾਗਤ ਨਹੀਂ ਹੈ ਅਸੀਂ ਘਰ ਦੇ ਚਾਰ ਮੈਂਬਰ ਹਾਂ ਅਤੇ ਚਾਰੋਂ ਦੇ ਚਾਰੋਂ ਹੀ ਨੌਕਰੀ ਕਰਦੇ ਹਾਂ ਸਰਕਾਰੀ ਨੌਕਰੀ ਹੋਣ ਕਰਕੇ ਅਸੀਂ ਸਵੇਰੇ ਸੱਤ ਵਜੇ ਘਰੋਂ ਦੀ ਚਲੇ ਜਾਂਦੇ ਹਾਂ ਅਤੇ ਸ਼ਾਮ ਨੂੰ ਘਰ ਵਾਪਸ ਆਉਂਦਿਆਂ ਸਾਨੂੰ ਛੇ ਵੱਜ ਜਾਂਦੇ ਹਨ ਇਸ ਕਰਕੇ ਅਸੀਂ ਟਿਫਨ ਲਗਵਾਉਣ ਦਾ ਸੋਚਿਆ ਹੈ ਤਾਂ ਕਿ ਥਕਾਵਟ ਹੋਣ ਕਰਕੇ ਸਾਨੂੰ ਰੋਟੀ ਬਣਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ ਧੰਨਵਾਦ